ਜਾਤੀ ਅਧਾਰਿਤ ਵਿਤਕਰਾ ਔਰਤਾਂ ਦੀ ਸਿੱਖਿਆ ਨਸਲਵਾਦ ਕੰਨਿਆ ਭਰੂਣ ਹੱਤਿਆ ਸਤੀ ਪ੍ਰਥਾ ਆਦਿ ਜਿਹੜੇ ਰੀਤੀ ਰਿਵਾਜ਼ ਸਮਾਜ ਨੂੰ ਨੁਕਸਾਨ ਪਹੁੰਚਾ ਸਕਦੇ ਆ ਉਹ ਸਮਾਜ ਵਿੱਚ ਅਸਮਾਨਤਾ ਭੇਦ ਭਾਵ ਅਤੇ ਸ਼ੋਸ਼ਣ ਨੂੰ ਵਧਾਵਾ ਦਿੰਦੇ ਆ ਅਤੇ ਇਹ ਰੀਤੀ ਰਿਜਾ ਰਿਵਾਜ਼ ਜਿਹੜੇ ਆ ਸਮਾਜ ਵਿਚ ਆਦ ਆਦਮੀ ਦੇ ਮਾਨ ਸਮਾਨ ਨੂੰ ਖਤਰੇ ਵਿੱਚ ਪਾ ਸਕਦੇ ਅਤੇ ਬਰਬਾਦ ਵੀ ਕਰ ਸਕਦੇ ਆ ਇਸ ਲਈ ਸਮਾਜ ਨੂੰ ਇਹ ਰੀਤੀਆਂ ਦਾ ਜਿਹੜਾ ਤਿਰਸਕਾਰ ਕਰਨਾ ਚਾਹੀਦਾ ਅਤੇ ਮੇਰੀ ਨਜ਼ਰ ਅਨੁਸਾਰ ਇਸਤਰੀ ਜਿਹੜੀ ਏ ਜਨਨੀ ਹੈ ਅਤੇ ਕੋਈ ਵੀ ਸਮਾਜ ਜਿਹੜਾ ਵਾ ਜਿੰਨੀ ਦੇਰ ਨਾਰੀ ਤਰੱਕੀ ਨਹੀਂ ਕਰਦੀ ਉਹ ਉਨੀ ਦੇਰ ਨਹੀਂ ਉਹ ਉੱਨਤੀ ਕਰ ਸਕਦਾ ਹੋਰ ਸਮਾਜ ਵਿੱਚ ਜਿੰਨੀਆਂ ਵੀ ਬੁਰਾਈਆਂ ਫੈਲੀਆਂ ਉਹਨਾਂ ਨੂੰ ਦੂਰ ਕਰਨ ਲਈ ਵੀ ਜਿਹੜਾ ਵਾ ਨਾਰੀ ਨੂੰ ਸਿੱਖਿਆ ਦੇਣੀ ਬਹੁਤ ਜ਼ਰੂਰੀ ਹੈ ਹੋਰ ਇਸਤਰੀਆਂ ਦੀ ਦਸ਼ਾ ਜਿਹੜੀ ਆ ਉਹਨਾਂ ਦੀ ਹਾਲਤ ਸੁਧਾਰਨ ਲਈ ਬੜੇ ਖਾਸ ਕਦਮ ਚੁੱਕੇ ਜਾਣੇ ਚਾਹੀਦੇ ਹਨ ਹੋਰ ਜੇ ਕੋਈ ਦੇਸ਼ ਵਿਕਸਿਤ ਹੈ ਉਹਦਾ ਤਾਂ ਹੀ ਵਿਕਸਿਤ ਹੋਏਗਾ ਜੇ ਇਸਤਰੀਆਂ ਨੂੰ ਬਰਾਬਰ ਅਧਿਕਾਰ ਦਿੱਤੇ ਜਾਣਗੇ ਹੋਰ ਇਸਤਰੀਆਂ ਨੂੰ ਜਿਹੜੇ ਉਹਨਾਂ ਦੇ ਹੱਕ ਬਣਦੇ ਆ ਉਹਨਾਂ ਨੂੰ ਦਿੱਤੇ ਜਾਣ ਅਤੇ ਉਹਨਾਂ ਨੂੰ ਸੁਤੰਤਰਤਾ ਦਿੱਤੀ ਜਾਵੇ ਮੇਰੀ ਰਾਏ ਇਹੀ ਹੈ ਥੈਂਕਸ ਧੰਨਵਾਦ